ਉਣੱਤੀ ਸੱਤ ਸੌ ਉਨਾਸੀ ਨੌਂ ਹਜ਼ਾਰ ਅੱਠ ਸੌ ਨੜਿਨਵੇਂ ਪੈਂਹਠ ਹਜ਼ਾਰ ਸੱਤ ਸੌ ਇਕਾਸੀ ਸੱਤ ਲੱਖ ਤਰਤਾਲੀ ਹਜ਼ਾਰ ਦੋ ਸੌ ਉੱਨੀ